ਪਾਣੀ ਦੀ ਸਪਲਾਈ ਸਾਨੂੰ ਕਮੇਟੀ ਦਾ ਪਾਣੀ ਆਉਂਦਾ ਹੈ ਅਸੀਂ ਕੋਸ਼ਿਸ ਉਹੀ ਕਰਦੇ ਜ਼ਿਆਦਾਤਰ ਪਾਣੀ ਉਹ ਹੀ ਭਰਿਆ ਅਤੇ ਪੀ ਪ ਪੀਣ ਲਈ ਵਰਤਿਆ ਜਾਵੇ ਅਤੇ ਜੇ ਆਪਾਂ ਗੱਲ ਕਰੀਏ ਡ ਗਰਾਉਂਡ ਪਾਣੀ ਦੀ ਜਿਹੜਾ ਨੀਚੇ ਧਰਤੀ ਤੋਂ ਕੱਢਣਾ ਪਾਣੀ ਉਹ ਸਾਫ਼ ਨਹੀਂ ਆਉਂਦਾ ਪਾਣੀ ਦੀ ਕਾਫ਼ੀ ਹਾਲਤ ਖਰਾਬ ਹੈ ਪੀਲਾ ਵੀ ਹੁੰਦਾ ਬਹੁਤ ਡੂੰਘਾ ਬੋਰ ਕਰਾਂਗੇ ਤਾਂ ਜਾ ਕੇ ਸਾਨੂੰ ਉਹ ਪਾਣੀ ਸਾਫ਼ ਮਿਲਦਾ ਬਾਕੀ ਪਾਣੀ ਸਾਫ਼ ਹੋਵੇ ਤਾਂ ਹੀ ਤੁਹਾਡੀ ਜ਼ਿੰਦਗੀ ਵਧੀਆ ਹੈਗੀ ਹੈ ਉਹਦੇ ਨਾਲ ਤੁਹਾਡੀ ਸਿਹਤ ਵਾਸਤੇ ਵੀ ਚੰਗਾ ਤੁਹਾਡੇ ਰਹਿਣ ਸਹਿਣ ਵਾਸਤੇ ਵੀ ਚੰਗਾ ਹੈ ਅਤੇ ਤੁਸੀਂ ਪਾਣੀ ਸਾਫ਼ ਤੁਹਾਨੂੰ ਨਹੀਂ ਮਿਲ ਰਿਹਾ ਤਾਂ ਤੁਸੀਂ ਵੀ ਬਿਮਾਰੀਆਂ ਤੋਂ ਘਿਰੇ ਹੋਏ ਹੋ ਗ੍ਰਸਤ ਹੋਏ ਰਹਿੰਦੇ ਹੋ